ਸੌਲ੍ਹਾਂ ਜੂਨ ਦੋ ਹਜ਼ਾਰ ਚਾਰ ਬਾਰ੍ਹਾਂ ਮਈ ਦੋ ਹਜ਼ਾਰ ਸੱਤ ਪੱਚੀ ਨਵੰਬਰ ਦੋ ਹਜ਼ਾਰ ਸੱਤ ਸੱਤ ਸਪਤੰਬਰ ਦੋ ਹਜ਼ਾਰ ਇੱਕੀ ਦਸ ਜੁਲਾਈ ਦੋ ਹਜ਼ਾਰ ਤੇਈ